ਮੈਂ ਪਿਛਲੇ ਸਾਲ ਰਾਜਸਥਾਨ ਗਿਆ ਸੀ ਉੱਥੇ ਉਨ੍ਹਾਂ ਦਾ ਰਹਿਣ ਸਹਿਣ ਦਾ ਢੰਗ ਬਹੁਤ ਸਾਦਾ ਸੀ ਉਨ੍ਹਾਂ ਦਾ ਪਹਿਰਾਵਾ ਬਹੁਤ ਵਧੀਆ ਸੀ ਉਹਨਾਂ ਉਨ੍ਹਾਂ ਦਾ ਰਹਿਣ ਸਹਿਣ ਦਾ ਢੰਗ ਬਹੁਤ ਵਧੀਆ ਲੱਗਿਆ ਅਤੇ ਉ ਉਨ੍ਹਾਂ ਦੀਆਂ ਭਾਸ਼ ਉਨ੍ਹਾਂ ਦੀ ਬੋਲੀ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾਂ ਦਾ ਪਹਿਰਾਵਾ ਵੀ ਬਹੁਤ ਸੁੰਦਰ ਹੈ